ਵੈਸੇ ਤਾਂ ਸ਼੍ਰੀ ਫਤਿਹਗੜ੍ਹ ਸਾਹਿਬ ਜ਼ਿਲ੍ਹੇ ਵਿੱਚ ਬਹੁਤ ਸਾਰੀਆਂ ਖੇਡਾਂ ਅਤੇ ਕਈ ਗਤੀਵਿਧੀਆਂ ਕਰਵਾਈ ਜਾਂਦੀਆਂ ਹਨ ਪਰ ਇਹਨਾਂ ਵਿੱਚੋਂ ਕਬੱਡੀ ਦੇ ਟੂਰਨਾਮੈਂਟ ਵੱਧ ਕਰਵਾਏ ਜਾਂਦੇ ਹਨ ਇਸ ਤੋਂ ਇਲਾਵਾ ਗੱਤਕਾ ਟੂਰਨਾਮੈਂਟ ਵੀ ਕਰਵਾਏ ਜਾਂਦੇ ਹਨ ਇਹਨਾਂ ਵਿੱਚ ਸਿਰਫ ਸਿੱਖਿਆਧਾਰੀ ਵਿਅਕਤੀਆਂ ਨੂੰ ਹੀ ਹਿੱਸਾ ਲੈਣਾ ਸਕਦੇ ਹਨ ਇਸ ਇਲਾਵਾ ਕ੍ਰਿਕਟ ਟੂਰਨਾਮੈਂਟ ਬੋਲੀਬੋਲ ਟੂਰਨਾਮੈਂਟ ਆਦਿ ਟੂਰ ਕਰ ਕਰਵਾਏ ਜਾਂਦੇ ਹਨ ਇਸ ਤੋਂ ਇਲਾਵਾ ਸ਼੍ਰੀ ਫਤਿਹਗੜ੍ਹ ਸਾਹਿਬ ਜ਼ਿਲ੍ਹੇ ਵਿੱਚ ਹੋਣ ਵਾਲਾ ਹੋਣ ਵਾਲੀ ਗਤੀਵਿਧੀ ਦਸਤਾਰ ਮੁਕਾਬਲਾ ਹੈ ਇਸ ਵਿੱਚ ਬੱਚਿਆਂ ਨੂੰ ਦਸਤਾਰ ਸਿਖਾਈ ਵੀ ਜਾਂਦੀ ਹੈ ਸ਼੍ਰੀ ਫਤਿਹਗੜ੍ਹ ਸਾਹਿਬ ਦੇ ਕੋਲਜ ਬਾਬਾ ਬੰਦਾ ਸਿੰਘ ਬਹਾਦਰ ਵਿੱਚ ਸਟੇਟ ਲੈਵਲ ਖੇਡਾਂ ਦਾ ਪ੍ਰੋਗਰਾਮ ਵੀ ਹੁੰਦਾ ਹੈ ਇਸ ਵਿੱਚ ਨੌਵੀਂ ਤੋਂ ਬਾਰ੍ਹਵੀਂ ਕਲਾਸ ਦੇ ਵਿਦਿਆਰਥੀ ਹਿੱਸਾ ਲੈਂਦੇ ਹਨ ਇਸ ਵਿੱਚ ਖੋ ਖੋ ਕਬੱਡੀ ਵੋਲੀਬੋਲ ਕ੍ਰਿਕਟ ਵ ਆਦਿ ਟੂਰਨਾਮੈਂਟ ਦਾ ਟੂਰਨਾਮੈਂਟ ਦਾ ਪ੍ਰੋਗਰਾਮ ਹੁੰਦਾ ਹੈ